ਸਾਡੀ ਰਿਸ਼ਤੇਦਾਰੀ ਵਿੱਚ ਮੇਰੀ ਭੂਆ ਦਾ ਮੁੰਡਾ ਹੈ ਉਹਨੂੰ ਮੈਂ ਹੁਣੇ ਥੋੜ੍ਹੇ ਥੋੜ੍ਹੇ ਥੋੜ੍ਹੇ ਦਿਨ ਪਹਿਲਾਂ ਨਾ ਇੱਕ ਸਲਾਹ ਦਿੱਤੀ ਸੀ ਕਿ ਸਾਡੇ ਖੇਤਰ ਵਿੱਚ ਜਿਲ੍ਹਾ ਫਤਿਹਗੜ੍ਹ ਸਾਹਿਬ 'ਚ ਕੋਲਜ ਹੈ ਇੱਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕੋਲਜ ਹੈ ਅਤੇ ਵੈਸੇ ਤਾਂ ਹੋਰ ਵੀ ਬਹੁਤ ਸਾਰੇ ਕੋਲਜ ਨੇ ਜਿੱਦਾਂ ਕਿ ਯ ਇੱਕ ਯੂਨੀਵਰਸਿਟੀ ਵੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਉਸਤੋਂ ਬਾਅਦ ਇੱਕ ਕੋਲਜ ਆ ਮਾਤਾ ਗੁਜਰੀ ਕੋਲਜ ਅਤੇ ਮੈਂ ਉਸ ਨੂੰ ਇੱਧਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕੋਲਜ ਦੀ ਸਲਾਹ ਦਿੱਤੀ ਸੀ ਕਿ ਤੂੰ ਇੰਜੀਨੀਅਰਿੰਗ ਦੀ ਦਾ ਡਿਪਲੋਮਾ ਕਰ ਅਤੇ ਉਸ ਤੋਂ ਬਾਅਦ ਡਿਗਰੀ ਕਰ ਡਿਗਰੀ ਕਰਨ ਤੋਂ ਬਾਅਦ 'ਚ ਵੀ ਅੱਗੇ ਜੋ ਵੀ ਫੀਲਡ ਵਿੱਚ ਜਾਏਗਾ ਟੈਕਨੋਲਜੀ ਦਾ ਬਹੁਤ ਜ਼ਮਾਨਾ ਹੈ ਅੱਗੇ ਤੋਂ ਅੱਗੇ ਕਿ ਵਧੀਆ ਨੌਲੇਜ ਲੈ ਕੇ ਵਧੀਆ ਰੈਂਕ ਲੈ ਕੇ ਆਪਣੀ ਜੋ ਵੀ ਜੋਬ ਅਪਲਾਈ ਕਰਨੀ ਹੈ ਉਹ ਕਰਕੇ ਵਧੀਆ ਮੁਕਾਮ ਹਾਸਿਲ ਕਰੇ ਆਪਣਾ